ਜਿਵੇਂ ਜਿਵੇਂ ਆਪਾਂ ਦੇਖਦੇ ਹਾਂ ਕਿ ਆਪਣੇ ਇਲਾਕਿਆਂ ਦੇ ਨਾਲ ਲੱਗਦੇ ਸ਼ਹਿਰ ਉੱਭਰਦੇ ਜਾ ਰਹੇ ਆ ਡਿਵੈਲਪ ਹੁੰਦੇ ਜਾ ਰਹੇ ਆ ਉਸਦੇ ਨਾਲ ਹੀ ਪੇਂਡੂ ਇਲਾਕਿਆਂ ਨੂੰ ਵੀ ਉੱਭਰਨਾ ਚਾਹੀਦਾ ਜਾਂ ਕਹਿ ਸਕਦੇ ਉੱਭਰਨ ਦੀ ਲੋੜ ਹੈ ਆਪਾਂ ਦੇਖਦੇ ਹਾਂ ਕਿ ਸ਼ਹਿਰਾਂ ਵਿੱਚ ਤਾਂ ਬੱਸਾਂ ਜਾਂ ਕਹਿ ਸਕਦੇ ਔਟੋ ਬਹੁਤ ਚੱਲਦੇ ਹਨ ਕੁਛ ਪੇਂਡੂ ਇਲਾਕੇ ਇਹੋ ਜਿਹੇ ਹੁੰਦੇ ਹਨ ਜਿੱਥੇ ਆਵਾਜਾਈ ਦੇ ਸਾਧਨ ਘੱਟ ਜਾਂਦੇ ਹਨ ਜਾਂ ਕਹਿ ਸਕਦੇ ਬਿਲਕੁਲ ਜਾਂਦੇ ਹੀ ਨਹੀ ਇਸ ਲਈ ਸਾਨੂੰ ਦੇਖਣਾ ਚਾਹੀਦਾ ਯਤਨ ਕਰਨੇ ਚਾਹ ਚਾਹੀਦੇ ਜਾਂ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ ਕਿ ਹਰ ਇੱਕ ਪਿੰਡ ਸ਼ਹਿਰ ਨੂੰ ਇਸ ਤਰ੍ਹਾਂ ਲਿੰਕ ਕੀਤਾ ਜਾਵੇ ਕਿ ਹਰ ਇੱਕ ਵਿਅਕਤੀ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰ ਸਕੇ ਸ਼ਹਿਰ ਤੋਂ ਪਿੰਡ ਜਾਣ ਦੀ ਸੁਵਿਧਾ ਹੋਣੀ ਚਾਹੀਦੀ ਪਿੰਡਾਂ ਤੋਂ ਸ਼ਹਿਰ ਜਾਣ ਦੀ ਹਰ ਸਮੇਂ ਟਰਾਂਸਪੋਰਟ ਚੱਲਦੀ ਹੋਣੀ ਚਾਹੀਦੀ ਹੈ ਜਿਵੇਂ ਕਹਿ ਸਕਦੇ ਹਨ ਕਿ ਹਰ ਇੱਕ ਪਿੰਡ ਅਤੇ ਸ਼ਹਿਰ ਨੂੰ ਲਿੰਕ ਕਰਕੇ ਦੋ ਤੋਂ ਤਿੰਨ ਬੱਸਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਸਰਕਾਰੀ ਜੋ ਕਿ ਪਿੰਡਾਂ ਅਤੇ ਸ਼ਹਿਰਾਂ ਤੋਂ ਚੱਲ ਕੇ ਹੋਰ ਸ਼ਹਿਰਾਂ ਵਿੱਚ ਜਾਣ ਕਿਉਂਕਿ ਹਰ ਇੱਕ ਵਿਅਕਤੀ ਨੂੰ ਸ਼ਹਿਰਾਂ ਵਿੱਚ ਸਮਾਨ ਲੈਣ ਦੀ ਲੋੜ ਪੈਂਦੀ ਹੈ ਸ਼ਹਿਰਾਂ ਵਿੱਚ ਆਉਣਾ ਆਪਣਾ ਲੋੜ ਵ ਲੋ ਜ਼ਰੂਰੀ ਲੋੜਾਂ ਲੋੜਵੰਦ ਚੀਜ਼ਾਂ ਹੋ ਗਈਆਂ ਕੁਛ ਹੋਰ ਹੋ ਗਿਆ ਆਪਾਂ ਲੈਣਾ ਆ ਉਹ ਲੈਣ ਆਉਣ ਲਈ ਹਰ ਇੱਕ ਕੋਲ ਆਪਣਾ ਪਰਸਨਲ ਸਾਧਨ ਨਹੀਂ ਹੁੰਦਾ ਹੈ ਇਸ ਲਈ ਉਹਨੂੰ ਸਰਕਾਰੀ ਸਾਧਨਾਂ ਦੀ ਲੋੜ ਪੈਂਦੀ ਹੈ ਆਵਾਜਾਈ ਦੇ ਸਾਧਨਾਂ ਦੀ ਲੋੜ ਪੈਂਦੀ ਹੈ ਅਤੇ ਉਹ ਲਗਾਉਣੀਆਂ ਚਾਹੀਦੀਆਂ ਜਿਵੇਂ ਬਸ ਬੱਸਾਂ ਆਉਣੀਆਂ ਚਾਹੀਦੀਆਂ ਬੱਸਾਂ ਦੇ ਵਿੱਚ ਆਉਣਾ ਜਾਣਾ ਆਸਾਨ ਹੈ ਅਤੇ ਪਬਲਿਕ ਨੂੰ ਵੀ ਚਾਹੀਦਾ ਹੈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੀ ਦੇਖਭਾਲ ਕਰਨ ਉਹਨਾਂ ਨੂੰ ਆਪਣੀ ਚੀਜ਼ ਸਮਝਣ ਉਹਨਾਂ ਦੀ ਸਫਾਈ ਰੱਖੇ ਅਤੇ ਟਾਇਮ ਸਿਰ ਆਉਣ 'ਤੇ ਜੋ ਟੈਕਸ ਬਣਦਾ ਆ ਲੋਕਾਂ ਨੂੰ ਦੇਣਾ ਚਾਹੀਦਾ ਆ ਉਹਨਾਂ ਟੈਕਸ ਦੇ ਨਾਲ ਹੀ ਇਹ ਸਾਧਨ ਅੱਗੇ ਤੋਂ ਅੱਗੇ ਬਿਹਤਰ ਬਣਦੇ ਹਨ ਹੋਰ ਕਹਿ ਸਕਦੇ ਹਨ ਕਿ ਜਿਸ ਵਿਅਕਤੀ ਕੋਲ ਜ਼ਿਆਦਾ ਪੈਸਾ ਹੈ ਉਹ ਆਪਣੀ ਇੱਕ ਟਰਾਂਸਪੋਰਟ ਬਣਾ ਸਕਦਾ ਏ ਉਹ ਟਰਾਂਸਪੋਰਟ ਦੇ ਜਰੀਏ ਔਟੋ ਪਾ ਸਕਦੇ ਜਾਂ ਗੱਡੀਆਂ ਪਾ ਸਕਦਾ ਹੈ ਜੋ ਪਿੰਡਾਂ ਸ਼ਹਿਰਾਂ ਤੋਂ ਲਿੰਕ ਹੋ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਨੂੰ ਸੁਵਿਧਾ ਦੇਣ ਘੱਟ ਰੇਟਾਂ ਵਿੱਚ ਹੋਰ ਕਹਿ ਸਕਦੇ ਹਾਂ ਕਿ ਜਿਵੇਂ ਕਿ ਚੰਡੀਗੜ੍ਹ ਦੇਖ ਸਕਦੇ ਹਾਂ ਹੁਣ ਮੋਟਰਸਾਈਕਲ 'ਤੇ ਵੀ ਰਾਈਡ ਹੁੰਦੀ ਹੈ ਤੁਸੀਂ ਜੇ ਅੱਗੇ ਤਾਂ ਗੱਡੀਆਂ ਬੁੱਕ ਕਰਦੇ ਸੀ ਹੁਣ ਤੁਸੀਂ ਰਾਈਡ ਕਰ ਸਕਦੇ ਹੋ ਮੋਟਰਸਾਈਕਲ ਦੇ ਬੁੱਕ ਬਹੁਤ ਘੱਟ ਪੈਸਿਆਂ ਵਿੱਚ ਹੋ ਜਾਂਦੀ ਹੈ ਮੋਟਰਸਾਈਕਲ 'ਤੇ ਆਪਣਾ ਜਾ ਸਕਦੇ ਹੋ ਕਿਸੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਬਹੁਤ ਘੱਟ ਪੈਸਿਆਂ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਪਿੰਡਾਂ ਵਿੱਚ ਵੀ ਇਹ ਸੁਵਿਧਾਵਾਂ ਹੌਲੀ ਹੌਲੀ ਚਾਲੂ ਹੋਣੀਆਂ ਚਾਹੀਦੀਆਂ ਹਨ ਜਿਹਨਾਂ ਨਾਲ ਕਿ ਹਰ ਇੱਕ ਵਿਅਕਤੀ ਨੂੰ ਲਾਭ ਹੋਊਂਗਾ ਹਰ ਇੱਕ ਵਿਅਕਤੀ ਅਡਵਾਂਸ ਹੋਊਂਗਾ ਕੋਈ ਬੈਕਵਰਡ ਨਹੀਂ ਹੋਊਂਗਾ ਉਹਨਾਂ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਏ ਕਈ ਵਾਰ ਕੀ ਹੁੰਦਾ ਹੈ ਕਿ ਪਿੰਡਾਂ ਵਿੱਚ ਕੋਈ ਬਿਮਾਰ ਹੋ ਜਾਂਦਾ ਏ ਕੋਈ ਜ਼ਰੂਰਤ ਹੁੰਦੀ ਹੈ ਕੋਈ ਸਾਧਨ ਨਹੀਂ ਮਿਲਦਾ ਇਸ ਲਈ ਹਰ ਪਿੰਡ ਵਿੱਚ ਇੱਕ ਸਰਕਾਰੀ ਗੱਡੀ ਕਹਿ ਸਕਦੇ ਜਾਂ ਵੀ ਕਹਿ ਸਕਦੀ ਐਂਬੂਲੈਂਸ ਦੀ ਸੁਵਿਧਾ ਹੋਣੀ ਚਾਹੀਦੀ ਹੈ ਉਹ ਵੀ ਬਹੁਤ ਜ਼ਰੂਰੀ ਹੈ